ਹਾਂ ਮੈਂ ਇੱਕ ਯਾਦਗਾਰ ਅਨੁਭਵ ਸਾਂਝਾ ਕਰ ਸਕਦੀ ਹਾਂ ਜਿੱਥੇ ਮੈਨੂੰ ਆਪਣੀ ਡਰਾਇੰਗ ਬਾਰੇ ਕਾਫੀ ਫੀਡਬੈਕ ਮਿਲੇ ਸਨ ਮੈਂ ਇੱਕ ਵਾਰ ਆਪਣੇ ਭੂਆ ਦੇ ਘਰ ਜੰਮੂ ਵਿੱਚ ਗਈ ਸੀ ਉਹ ਜੰਮੂ ਸ਼ਹਿਰ ਤੋਂ ਵੀ ਕਾਫੀ ਅੱਗੇ ਅਕਨੂਰ ਵਿੱਚ ਰਹਿੰਦੇ ਹਨ ਮੈਂ ਉੱਥੇ ਸ਼ਾਮ ਨੂੰ ਬਾਹਰ ਸੈਰ ਕਰਨ ਨਹੀਂ ਨਿਕਲੀ ਅਤੇ ਉੱਥੇ ਮੈਂ ਬਹੁਤ ਸਾਰੇ ਪਹਾੜ ਦੇਖੇ ਉਹ ਪਹਾੜ ਬਰਫ ਨਾਲ ਟਕੇ ਹੋਏ ਹਨ ਅਤੇ ਮੈਂ ਉਹਨਾਂ ਦੀ ਤਸਵੀਰ ਬਣਾਉਣੀ ਸ਼ੁਰੂ ਕਰ ਦਿੱਤੀ ਅਤੇ ਉਹ ਤਸਵੀਰ ਬਹੁਤ ਹੀ ਸੋਹਣੀ ਬਣੀ ਮੇਰੇ ਨਾਲ ਮੇਰੇ ਭੂਆ ਦੇ ਬੱਚੇ ਵੀ ਗਏ ਸਨ ਉਹ ਵੀ ਉਸ ਤਸਵੀਰ ਨੂੰ ਦੇਖ ਕੇ ਬਹੁਤ ਖੁਸ਼ ਹੋਏ ਉਥੋਂ ਦੀ ਕੁਝ ਰਾਹੀ ਜਾ ਰਹੇ ਸਨ ਉਹਨਾਂ ਨੇ ਸਾਨੂੰ ਦੇਖਿਆ ਕਿ ਇਹ ਬੱਚੇ ਕੀ ਕਰ ਰਹੇ ਸਨ ਅਤੇ ਉਹ ਸਾਨੂੰ ਦੇਖ ਕੇ ਰੁਕ ਗਏ ਉਹਨਾਂ ਨੇ ਜਦੋਂ ਤਸਵੀਰ ਦੇਖੀ ਤਾਂ ਉਹ ਬਹੁਤ ਖੁਸ਼ ਹੋਏ ਉਹ ਕਹਿਣ ਲੱਗੇ ਕਿ ਤੁਸੀਂ ਸਾਡੀ ਵੀ ਤਸਵੀਰ ਬਣਾ ਸਕਦੇ ਹੋ ਅਤੇ ਮੈਂ ਉਹਨਾਂ ਨੂੰ ਕਿਹਾ ਹਾਂਜੀ ਮੈਂ ਕੋਸ਼ਿਸ਼ ਕਰ ਸਕਦੀ ਹਾਂ ਮੈਂ ਤੁਹਾਡੀ ਵੀ ਤਸਵੀਰ ਬਣਾ ਸਕਦੀ ਹਾਂ ਅਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਸਾਡੀ ਤਸਵੀਰ ਬਣਾ ਕੇ ਦਿਖਾ ਦਿਓ ਅਤੇ ਉਹ ਬੈਠ ਗਏ ਮੈਂ ਉਹਨਾਂ ਦੀ ਤਸਵੀਰ ਬਣਾਉਣੀ ਸ਼ੁਰੂ ਕਰ ਦਿੱਤੀ ਉਹ ਬੈਠੇ ਰਹੇ ਕੁਝ ਸਮੇਂ ਬਾਅਦ ਮੈਂ ਉਹਨਾਂ ਨੂੰ ਉਹਨਾਂ ਦੀ ਤਸਵੀਰ ਦਿਖਾਈ ਅਤੇ ਉਹ ਬਹੁਤ ਹੀ ਖੁਸ਼ ਹੋਏ ਉਹਨਾਂ ਨੇ ਮੈਨੂੰ ਇੱਕ ਅੱਛਾ ਫੀਡਬੈਕ ਦਿੱਤਾ ਉਹਨਾਂ ਨੇ ਮੈਨੂੰ ਇਨਾਮ ਵੀ ਦਿੱਤਾ ਇਨਾਮ ਵਿੱਚ ਉਹਨਾਂ ਨੇ ਮੈਨੂੰ ਪੰਜ ਸੌ ਰੁਪਇਆ ਦਿੱਤਾ ਅਤੇ ਮੈਂ ਨਹੀਂ ਸੀ ਲੈ ਰਹੀ ਪਰ ਉਹਨਾਂ ਨੇ ਕਿਹਾ ਇਹ ਤੇਰੇ ਸਮੇਂ ਕਰਕੇ ਤੈਨੂੰ ਦਿੱਤਾ ਹੈ ਤੂੰ ਸਾਡੇ ਲਈ ਮਿਹਨਤ ਕੀਤੀ ਹੈ ਅਤੇ ਤੇਰਾ ਇਨਾਮ ਬਣਦਾ ਹੈ ਅਤੇ ਤੇਰੀ ਡਰਾਇੰਗ ਇੱਕ ਦਿਨ ਜ਼ਰੂਰ ਤੇਰੇ ਲਈ ਸਫਲਤਾ ਦਾ ਸਾਧਨ ਬਣੇਗੀ ਮੈਂ ਇਸ ਚੀਜ਼ ਨੂੰ ਸੁਣ ਕੇ ਬਹੁਤ ਖੁਸ਼ ਹੋਈ ਅਤੇ ਮੈਂ ਇੱਦਾਂ ਹੀ ਹੋਰ ਵੀ ਲੋਕਾਂ ਦੀਆਂ ਤਸਵੀਰਾਂ ਬਣਾਉਣੀਆ ਸ਼ੁਰੂ ਕਰ ਦਿੱਤੀਆਂ ਅਤੇ ਮੈਨੂੰ ਹੋਰ ਵੀ ਜਣਿਆ ਨੇ ਇਸੇ ਤਰ੍ਹਾਂ ਇਨਾਮ ਦਿੱਤੇ ਅਤੇ ਮੈਂ ਬਹੁਤ ਖੁਸ਼ ਹੋਈ